ਪੰਦਰ੍ਹਾਂ ਪੰਦਰ੍ਹਾਂ ਜਨਵਰੀ ਉੱਨੀ ਸੌ ਸੱਠ ਦੋ ਫਰਵਰੀ ਦੋ ਹਜ਼ਾਰ ਛੇ ਤਿੰਨ ਨਵੰਬਰ ਦੋ ਹਜ਼ਾਰ ਗਿਆਰ੍ਹਾਂ ਪੰਜ ਫਰਵਰੀ ਦੋ ਹਜ਼ਾਰ ਅਠਾਰ੍ਹਾਂ ਦਸ ਜੂਨ ਦੋ ਹਜ਼ਾਰ ਸੱਤ